ਚੌਵੀ ਮਈ ਉੱਨੀ ਸੌ ਸਤਾਸੀ ਤੇਰਾਂ ਅਪ੍ਰੈਲ ਉੱਨੀ ਸੌ ਬੱਨਵੇਂ ਤੇਰਾਂ ਅਗਸਤ ਉੱਨੀ ਸੌ ਬੱਨਵੇਂ ਇੱਕ ਜਨਵਰੀ ਦੋ ਹਜ਼ਾਰ ਚੌਵੀ ਨੌ ਫਰਵਰੀ ਉੱਨੀ ਸੌ ਸਤੱਨਵੇ